ਮੈਂ ਆਪਣੇ ਭਾਈਚਾਰੇ ਅਤੇ ਧਾਰਮਿਕ ਆਗੂ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਏ ਉਹਨਾਂ ਨੂੰ ਸਰਬੰਸ ਦਾਨੀ ਕਿਹਾ ਜਾਂਦਾ ਹੈਗਾ ਅਤੇ ਨੋਵੇਂ ਗੁਰੂ ਸ਼੍ਰੀ ਗੁਰੂ ਗ ਤੇਗ ਬਹਾਦਰ ਜੀ ਦੇ ਉਹ ਪੁੱਤਰ ਹੋਏ ਹੈਗੇ ਹੈ ਉਹਨਾਂ ਨੇ ਤੇਰ੍ਹਾਂ ਅਪ੍ਰੈਲ ਸੋਲ੍ਹਾਂ ਸੌ ਨੜਿਨਵੇਂ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨੇ ਹੱਕ ਸੱਚ ਲਈ ਲੜਨਾ ਸਿਖਾਇਆ ਅਤੇ ਗਰੀਬ ਮਜ਼ਲੂਮ ਲਈ ਖੜ੍ਹਨਾ ਸਿਖਾਇਆ ਉਹਨਾਂ ਨੇ ਮੈਨੂੰ ਸਿੱਖੀ ਲਈ ਪ੍ਰੇਰਿਆ ਉਹਨਾਂ ਤੋਂ ਮੈਂ ਪ੍ਰੇਰਿਤ ਹੋ ਕੇ ਅੰਮ੍ਰਿਤ ਛੱਕਿਆ ਅਤੇ ਆਪਣੇ ਪਰਿਵਾਰ ਨੂੰ ਵੀ ਛੱਕਣ ਲਈ ਪ੍ਰੇਰਿਤ ਕੀਤਾ